ਸਾਡੇ ਪੁਰਾਣੇ ਸਿੱਕੇ ਜਿਵੇਂ ਦੁੱਕੀ ਤਿੱਕੀ ਤਾਂਬੇ ਦੇ ਸਿੱਕੇ ਚਾਂਦੀ ਦੇ ਸਿੱਕੇ ਅਤੇ ਹੋਰ ਕਈ ਤਰ੍ਹਾਂ ਦੇ ਸਿੱਕੇ ਹੈ ਜੋ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ੇ ਕਰਦੇੇ ਨੇ ਜਿਨ੍ਹਾਂ ਨਾਲ਼ ਸਾਡਾ ਬਚਪਨ ਬੀਤਿਆ ਹੁੰਦਾ ਹੈ ਅਤੇ ਜਿਸ ਚੀਜ਼ਾਂ ਨਾਲ਼ ਅਸੀਂ ਖੇਡ ਕੇ ਸਾਡੇ ਦਿਮਾਗ 'ਚ ਰਹਿੰਦੀਆਂ ਹਨ ਉਨ੍ਹਾਂ ਨੂੰ ਜਿਵੇਂ ਦੁੱਕੀ ਹੋ ਗਈ ਪੁਰਾਣੀ ਤਿੱਕੀ ਹੋ ਗਈ ਚਾਂਦੀ ਦਾ ਸਿੱਕਾ ਹੋ ਗਿਆ ਹੋਰ ਪੁਰਾਣੀਆਂ ਹੋਰ ਕਈ ਆਈਟਮਾਂ ਹਨ ਚਟਾਨਾਂ ਜਿਵੇਂ ਪਹਾੜ ਅੱਲ੍ਹਮ ਗੱਲ੍ਹਮ ਹੋਰ ਕਈ ਆਈਟਮਾਂ ਹੁੰਦੀਆਂ ਹਨ ਜੋ ਸਾਡੇ ਬਚਪਨ ਦੀਆਂ ਚੀਜ਼ਾਂ ਨੂੰ ਤਾਜ਼ਾ ਕਰਦੀਆਂ ਇਹ ਚੀਜ਼ਾਂ ਨਾਲ਼ ਦਿਮਾਗ 'ਚ ਪੁਰਾਣੇ ਤੌਰ 'ਤੇ ਯਾਦ ਰਹਿੰਦੀਆਂ ਹਨ